ਮੈਂ ਪੰਜਾਬ ਵਿੱਚ ਰਹਿਣ ਵਾਲਾ ਵਾਸੀ ਹਾਂ ਅਤੇ ਮੈਂ ਪਸ਼ੂ ਪਾਲਣ ਦੀ ਟਿਕਾਓ ਖੇਤੀ ਕਰਨ ਦੇ ਵਿੱਚ ਮੈਂ ਮੁਰਗੀਆਂ ਦਾ ਪਾਲਣ ਕਰਦਾ ਹਾਂ ਮੈਂ ਪੋਟਲੀ ਫਾਰਮ ਪਾਇਆ ਹੋਇਆ ਹੈ ਇਸ ਪੋਟਲੀ ਫਾਰਮ ਵਿੱਚ ਮੇਰੇ ਕੋਲ ਤਿੰਨ ਚਾਰ ਸੌ ਮੁਰਗੀ ਹੈ ਜਿਸ ਵਿੱਚ ਮੈਂ ਉਹਨਾਂ ਦਾ ਕਾਫੀ ਜ਼ਿਆਦਾ ਧਿਆਨ ਰੱਖਦਾ ਹਾਂ ਅਤੇ ਟਾਈਮ 'ਤੇ ਵੈਕਸੀਨੇਸ਼ਨ ਵੀ ਕਰਵਾਉਂਦਾ ਹਾਂ ਇਸ ਤੋਂ ਇਲਾਵਾ ਮੈਨੂੰ ਅੱਛੀ ਆਮਦਨ ਹੋ ਜਾਂਦੀ ਹੈ ਉਹਨਾਂ ਦਾ ਮੀਟ ਵੇਚ ਕੇ ਮੈਂ ਅੱਛੀ ਆਮਦਨ ਪ੍ਰਾਪਤ ਕਰਦਾ ਹਾਂ ਅਤੇ ਮੈਂ ਮੀਟ ਤੋਂ ਇਲਾਵਾ ਮੈਂ ਮੁਰਗੀਆਂ ਦੇ ਡੇਢ ਤੋਂ ਦੋ ਸੌ ਅੰਡੇ ਮਹੀਨੇ ਵਿੱਚ ਪ੍ਰਾਪਤ ਕਰਦਾ ਹਾਂ ਉਹਨਾਂ ਨੂੰ ਵੇਚ ਕੇ ਵੀ ਮੈਂ ਕਾਫੀ ਬੜੀਆ ਆਮਦਨ ਪ੍ਰਾਪਤ ਕਰ ਰਿਹਾ ਹਾਂ ਇਸ ਤੋਂ ਇਲਾਵਾ ਸਾਡੇ ਪੰਜਾਬ ਦੇ ਖੇਤਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਾਫੀ ਜ਼ਿਆਦਾ ਲੋਕਾਂ ਨੇ ਇਹ ਪਾਲਣ ਕੀਤਾ ਹੋਇਆ ਹੈ ਕਈਆਂ ਨੇ ਤਾਂ ਬੱਕਰੀਆਂ ਭੇਡਾਂ ਵੀ ਰੱਖੀਆਂ ਹੋਈਆਂ ਹਨ ਪਰ ਜ਼ਿਆਦਾਤਰ ਮੇਰੇ ਇਲਾਕੇ ਦੇ ਵਿੱਚ ਦੇਸੀ ਮੁਰਗੀ ਫਾਰਮ ਜ਼ਿਆਦਾ ਹਨ ਜਿਸ ਵਿੱਚ ਘਰੇਲੂ ਦੇਸੀ ਪੁਰਾਣੇ ਮੁਰਗੇ ਰੱਖੇ ਹੋਏ ਹਨ ਜਾਂ ਫਿਰ ਕੋਕਰੇਲ ਮੁਰਗੇ ਵੀ ਲੋਕ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਉਹਨਾਂ ਦੇ ਮੀਟ ਤੋਂ ਵੀ ਆਮਦਨ ਵਧੀਆ ਹੋ ਜਾਂਦੀ ਹੈ ਅਤੇ ਆਂਡੇ ਵੀ ਕਾਫੀ ਜ਼ਿਆਦਾ ਤੱਕ ਦੇ ਦਿੰਦੇ ਹਨ ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਪਸ਼ੂ ਪਾਲਣ ਵਿੱਚ ਪ੍ਰਾਈਵੇਟ ਬਿਜ਼ਨਸ ਕਰਨ ਨਾਲੋਂ ਵਧੀਆ ਆਪਸ਼ਨ ਪਸ਼ੂ ਪਾਲਣ ਹੈ ਅਤੇ ਨਾਲ ਸੇਵਾ ਹੋ ਜਾਂਦੀ ਹੈ ਨਾਲ ਘਰ ਦਾ ਖਾਤਰਾ ਵੀ ਖਰਚਾ ਵੀ ਨਿਕਲ ਜਾਂਦਾ ਹੈ